ਕੁਛ ਰਵਾਇਤੀ ਪੰਜਾਬੀ ਭੰਗੜਾ ਸੰਗੀਤਕ ਸਾਜ ਦੀ ਗੱਲ ਕਰੀਏ ਤਾਂ ਅਲਗੋਜਾ ਢੋਲ ਤੂੰਬੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਖ਼ਾਸ ਰਹਿੰਦੀਆਂ ਨੇ ਇਹਨਾਂ ਤੋਂ ਬਗੈਰ ਭੰਗੜਾ ਥੋੜ੍ਹਾ ਅਧੂਰਾ ਜਿਹਾ ਲੱਗਦਾ ਹੈ ਲੇਕਿਨ ਜੇ ਮੈਂ ਕਿਤੇ ਇੱਕ ਸਾਜ ਦੀ ਗੱਲ ਕਰਾਂ ਤੇ ਉਹ ਭੰਗੜੇ ਦੇ ਵਿੱਚ ਇਸਤੇਮਾਲ ਹੋਣ ਵਾਲਾ ਢੋਲ ਹੈ ਢੋਲ ਤੋਂ ਬਿਨਾਂ ਭੰਗੜਾ ਤਾਂ ਪੂਰਾ ਹੋ ਹੀ ਨਹੀਂ ਸਕਦਾ ਹੈ ਅਤੇ ਇਹ ਆਵਾਜ਼ ਨੂੰ ਇੱਕ ਅਲੱਗ ਹੀ ਤਾਲ ਨੂੰ ਦਿੰਦਾ ਹੈ ਅਤੇ ਜਦੋਂ ਢੋਲ ਵੱਜਦਾ ਹੈ ਅਤੇ ਆਵਾਜ਼ ਆਪਣੇ ਆਪ ਹੀ ਅ ਜੋ ਹੈ ਨਿਕਲਦੀ ਹੈ ਅਤੇ ਸਾਫ਼ ਹੋ ਜਾਂਦੀ ਆ ਆਵਾਜ਼ ਬੋਲਣ 'ਚ ਅਤੇ ਢੋਲ ਬਦਾ ਨਾਲ ਨਾਲ ਜੋ ਹੈ ਬੀਟ ਵੀ ਅਲੱਗ ਹੀ ਆਉਂਦੀ ਹੈ ਅਤੇ ਉਹਨੂੰ ਬੋਲਣ ਤੋਂ ਬਾਅਦ ਬੰਦਾ ਜੋ ਹੈ ਉਹ ਢੋਲ ਦੀ ਥਾਪ 'ਤੇ ਆਪਣੇ ਆਪ ਹੀ ਪੈਰ ਥਿਰਕਾਣੇ ਵੀ ਸ਼ੁਰੂ ਕਰ ਦਿੰਦਾ ਹੈ ਪੰਜਾਬ ਦੇ ਵਿੱਚ ਢੋਲ ਜੋ ਹੈ ਉਹ ਮੇਨ ਹੈ ਮੁੱਖ ਹੈ ਉਹਦੇ ਤੋਂ ਬਗੈਰ ਕੋਈ ਵੀ ਜੋ ਪੰਜਾਬੀ ਸੰਗੀਤ ਸਾਜ ਆ ਉਹ ਅਧੂਰਾ ਮੰਨਿਆ ਜਾਂਦਾ ਹੈ ਚਾਹੇ ਉਹ ਕੋਈ ਵਿਆਹ ਸ਼ਾਦੀ ਦਾ ਫੰਕਸ਼ਨ ਹੋਵੇ ਜਾਂ ਕੋਈ ਬਡੇ ਪਾਰਟੀ ਜਾਂ ਫਿਰ ਕੋਈ ਸੰਗਤ ਹੋਵੇ ਉੱਥੇ ਜ਼ਿਆਦਾਤਰ ਢੋਲ ਦਾ ਜੋ ਹੈ ਦਾ ਇਸਤੇਮਾਲ ਕੀਤਾ ਹੀ ਜਾਂਦਾ ਹੈ ਜੇ ਅਸੀਂ ਹੋਰ ਸਾਜ ਦੀ ਗੱਲ ਕਰੀਏ ਤਾਂ ਤਬਲਾ ਵੀ ਹੈ ਲੇਕਿਨ ਭੰਗੜੇ ਦੇ ਲਈ ਢੋਲ ਦਾ ਹੀ ਇਸਤੇਮਾਲ ਮੁੱਖ ਹੁੰਦਾ ਹੈ ਅਤੇ ਢੋਲ ਜੋ ਵੱਜਦਾ ਹੈ ਅਤੇ ਅਲੱਗ ਹੀ ਤਰੀਕੇ ਦਾ ਸੰਗੀਤ ਜੋ ਹੈ ਆਵਾਜ਼ ਜੋ ਹੈਗੀ ਹੈ ਉਹਦੀ ਗੂੰਜਦੀ ਹੈ